ਬੱਸਾਂ ਸਕੂਟਰ ਬਟ ਬੱਸਾਂ ਸਕੂਟਰ ਸਕੂਟਰ ਮੋਟਰਸਾਈਕਲਾਂ ਕਾਰਾਂ ਭਾਰਤੀ ਆਵਾਜਾਈ ਸਾਧਨ ਹਨ ਮੈਂ ਪੰਜਾਬ ਤੋਂ ਬੋਲਣ ਵਾਲੀ ਹਾਂ ਮੈਂ ਰੋਜ਼ ਹੀ ਸਿਲਾਈ ਸੈਂਟਰ ਜਾਂਦੀ ਹਾਂ ਬੱਸ ਪਰ ਬੱਸਾਂ ਵਿੱਚ ਬਹੁਤ ਹੀ ਰਸ਼ ਹੁੰਦਾ ਹੈ ਉੱਥੇ ਤਾਂ ਖੜ੍ਹਨ ਨੂੰ ਜਗ੍ਹਾ ਵੀ ਨਹੀਂ ਹੁੰਦੀ ਕਈ ਵਾਰ ਤਾਂ ਮੈਂ ਲੇਟ ਹੋ ਜਾਂਦੀ ਹਾਂ ਆਪਣਾ ਆਟੋ ਕਰਾ ਕੇ ਜਾਣਾ ਪੈਂਦਾ ਹੈ ਆਟੋ ਵਾਲੇ ਪੈਸੇ ਬਹੁਤ ਹੀ ਲੈਂਦੇ ਹਨ ਤਾਂ ਕਰਕੇ ਭਾਰਤੀ ਆਵਾਜਾਈ ਬਹੁਤ ਹੀ ਵੱਧ ਗਏ ਹਨ ਕਿ ਤੁਸੀਂ ਇਹਨਾਂ ਦਾ ਕੋਈ ਹੱਲ ਕਰੋ ਧੰਨਵਾਦ